ਮੁੱਖ ਕਲਾ ਰੂਪ ਹੈਗੇ ਇੱਥੇ ਮਿੱਟੀ ਦੇ ਬਰਤਨ ਕਿਉਂਕਿ ਮਿੱਟੀ ਦੇ ਬਰਤਨ 'ਚ ਜੇ ਆਪਾਂ ਖਾਵਾਂਗੇ ਅਤੇ ਖਿਲਾਵਾਂਗੇ ਮਿੱਟੀ ਦੇ ਬਰਤਨ ਕੀ ਹੈਗਾ ਇੱਕ ਨੈਚੁਰਲ ਆਪਣੀ ਚੀਜ਼ ਹੈਗੀ ਨੈਚੁਰਲ ਬਣੀ ਇੱਕ ਕੀ ਕਹਾਂ ਕਿ ਮਿੱਟੀ ਦੇ ਬਰਤਨ ਜੋ ਬਣਾਉਣਗੇ ਤਾਂ ਉਹਨਾਂ ਦਾ ਵੀ ਕੰਮ ਵਧੂਗਾ ਅਤੇ ਜੇ ਆਪਾਂ ਖਾਵਾਂਗੇ ਤਾਂ ਆਪਾਂ ਨੂੰ ਵੀ ਕੋਈ ਜਿਹੜਾ ਹੈਗਾ ਨੁਕਸਾਨ ਨਹੀਂ ਹੁੰਦਾ ਮਿੱਟੀ ਦੀਆਂ ਚੀਜ਼ਾਂ ਨਾਲ ਅਤੇ ਇਹ ਕੀ ਹੈਗਾ ਵਾ ਕਿ ਇੱਦਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮਿੱਟੀ ਦੇ ਦੀਵੇ ਬਣਾਉਂਦੇ ਹੁੰਦੇ ਆ ਕਿਉਂਕਿ ਉਹਨਾਂ ਚੀਜ਼ ਜਿਹੜਾ ਮਿੱਟੀ ਮਿੱਟੀ ਕੀ ਹੈਗੀ ਆ ਆਪਣੀ ਮਤਲਬ ਪੰਜਾਬ ਦੀ ਬੜੀ ਵਧੀਆ ਚੀਜ਼ ਹੈਗੀ ਮਿੱਟੀ ਕਿਉਂਕਿ ਆਪਾਂ ਉਹਦੇ ਨਾਲ ਜੁੜੇ ਹੁੰਦੇ ਹਾਂ ਅਤੇ ਇਸ ਕਰਕੇ ਕਿ ਮੁੱਖ ਕਲਾ ਰੂਪ ਆਪਣੇ ਮਿੱਟੀ ਹੈਗੀ ਆ